ਇੱਕੀ ਪੰਜ ਸੌ ਪੈਂਹਠ ਛੇ ਹਜ਼ਾਰ ਸੱਤ ਸੌ ਨੱਬੇ ਅੱਸੀ ਹਜ਼ਾਰ ਨੌਂ ਸੌ ਸੱਤ ਲੱਖ ਅੱਸੀ ਹਜ਼ਾਰ ਸੱਤ ਸੌ ਵੀਹ